ਪੰਜਾਬੀ ਭਾਸ਼ਾ ਮੇਰੀ ਮਾਤ ਭਾਸ਼ਾ ਹੈ ਪਰ ਪੰਜਾਬੀ ਭਾਸ਼ਾ ਨੂੰ ਸਿੱਖਣ ਲਈ ਮੈਨੂੰ ਕਾਫੀ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਬਚਪਨ 'ਚ ਪੰਜਾਬੀ ਭਾਸ਼ਾ ਨੂੰ ਲਿਖਣ 'ਚ ਮੈਨੂੰ ਕਾਫੀ ਅਸੁਵਿਧਾ ਹੋਈ ਸੀ ਕਈ ਅੱਖਰ ਜਿਸ ਤਰ੍ਹਾਂ ਉੜਾ ਐੜਾ ਵੀ ਕਹਿ ਲਉ ਉਹ ਮੈਨੂੰ ਕਾਫੀ ਲਿਖਣ 'ਚ ਮੁਸ਼ਕਿਲ ਆਈ ਸੀ ਪਰ ਹੌਲੀ ਹੌਲੀ ਮੇਰਾ ਜੋ ਲਿਖਣ ਦਾ ਢੰਗ ਹੈ ਜਾਂ ਅਨੁਵਾਦ ਉਹਦੇ 'ਚ ਕਾਫੀ ਸੁਧਾਰ ਆਉਂਦਾ ਗਿਆ ਔਰ ਇਹਦੇ ਨਾਲ ਹੀ ਦੇਖੋ ਅੱਜ ਦੇ ਟਾਈਮ ਵਿੱਚ ਮੈਂ ਕਾਫੀ ਅੱਛੀ ਤਰ੍ਹਾਂ ਪੰਜਾਬੀ ਪੜ੍ਹ ਵੀ ਲੈਂਦੀ ਹਾਂ ਲਿਖ ਵੀ ਲੈਂਦੀ ਹਾਂ ਅਤੇ ਸਕੂਲ ਟਾਈਮ ਵਿੱਚ ਅਤੇ ਕੋਲਜ ਟਾਈਮ 'ਚ ਮੈਂ ਕਾਫੀ ਸਾਰੇ ਲੇਖਾ ਮੁਕਾਬਲਿਆਂ ਬੋਲਣ ਮੁਕਾਬਲੇ 'ਚ ਵੀ ਹਿੱਸਾ ਲਿਆ ਅਤੇ ਅੱਜ ਇਸ ਵਰਤਮਾਨ ਸਮੇਂ 'ਚ ਮੈਂ ਕੋਲਜ ਇਸ ਤਰ੍ਹਾਂ ਪੜ੍ਹਾ ਰਹੀ ਹਾਂ ਕਾਫੀ ਸਾਰੇ ਭਾਸ਼ਣ ਕਾਫੀ ਸਾਰੇ ਸੈਮੀਨਾਰ ਪੰਜਾਬੀ 'ਚ ਦਿੰਦੀ ਰਹੀ ਹਾਂ ਅਤੇ ਮੇਰਾ 'ਤੇ ਕਹਿਣਾ ਹੀ ਹੈ ਕਿ ਜਿਸ ਤਰ੍ਹਾਂ ਸਾਡੀ ਪੰਜਾਬੀ ਮਾਤ ਭਾਸ਼ਾ ਹੈ ਤਾਂ ਸਾਨੂੰ ਹਰੇਕ ਕੰਮ ਹੈ ਉਹ ਪੰਜਾਬੀ ਵਿੱਚ ਕਰਨਾ ਚਾਹੀਦਾ ਹੈ ਜਿਸ ਤਰਾਂ ਹੁਣ ਦੇ ਟਾਈਮ ਵਿੱਚ ਸਾਡੀ ਸਰਕਾਰ ਨੇ ਵੀ ਪੰਜਾਬੀ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ ਹ ਹਰੇਕ ਦੁਕਾਨ ਜਾਂ ਕੋਈ ਵੀ ਕਹਿ ਲਉ ਬਿਜ਼ਨਸ ਹੈ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਹੀ ਲਿਖਣ ਕਿਹਾ ਹੈ ਚਾਹੇ ਉਹ ਹੋਡਿੰਗ ਹੋਵੇ ਜਾਂ ਕੁਛ ਵੀ ਏ ਪੰਜਾਬੀ ਵਿੱਚ ਇਹਨਾਂ ਨੂੰ ਲਿਖਣ ਲਈ ਜ਼ਿਆਦਾ ਅਹਿਮੀਅਤ ਦਿੱਤੀ ਹੋਈ ਹੈ